ਪੰਜਾਬ ਦੇ ਵਿੱਚ ਬਹੁਤ ਸਾਰੇ ਕਾਰੋਬਾਰ ਕੀਤੇ ਜਾਂਦੇ ਆ ਬਹੁਤ ਸਾਰੇ ਕਾਰੋਬਾਰੀ ਵੀ ਆ ਜੋ ਕਾਫੀ ਸਫਲ ਹੋ ਗਏ ਆ ਆਪਣੀ ਸਫਲਤਾ ਦੀਆਂ ਪੌੜੀਆਂ ਚੜ੍ਹ ਚੁੱਕੇ ਹਾਂ ਮੈਂ ਤੁਹਾਨੂੰ ਆਪਣੀ ਭੈਣ ਦੀ ਗੱਲ ਸੁਣਾਉਣਾ ਚਾਹੁੰਦੀ ਹਾਂ ਜੋ ਕਿ ਇੱਕ ਕਾਰੋਬਾਰੀ ਹੈ ਉਸਨੇ ਸਾਂਝੇ ਤੌਰ 'ਤੇ ਆਪਣੀ ਸਹੇਲੀ ਦੇ ਨਾਲ ਇੱਕ ਬਿਊਟੀ ਅਕੈਡਮੀ ਸਟਾਰਟ ਕੀਤੀ ਸੀ ਬਿਊਟੀ ਅਕੈਡਮੀ ਦੇ ਵਿੱਚ ਸੈਲੂਨ ਦਾ ਕੰਮ ਦਾ ਪਾਰਟਨਸ਼ਿਪ ਕੀਤੀ ਉਸਨੇ ਆਪਣੀ ਸਹੇਲੀ ਦਾ ਮਿਲ ਕੇ ਆਪਣੀ ਬਿਊਟੀ ਅਕੈਡਮੀ ਨੂੰ ਕਾਫੀ ਅੱਗੇ ਤੱਕ ਲੈ ਕੇ ਗਈ ਉਸਨੇ ਪਹਿਲਾਂ ਇੱਕ ਬ੍ਰਾਂਚ ਸ਼ੁਰੂ ਕੀਤੀ ਇੱਕ ਸ਼ਹਿਰ ਦੇ ਵਿੱਚ ਅਤੇ ਹੁਣ ਅੱਜ ਦੇ ਟਾਈਮ ਉਸਦੀਆਂ ਪੰਜ ਬ੍ਰਾਂਚਾਂ ਹਨ ਵੱਖ ਵੱਖ ਸ਼ਹਿਰਾਂ ਦੇ ਵਿੱਚ ਉਹ ਆਪਣੀ ਬਿਊਟੀ ਅਕੈਡਮੀ ਦੇ ਜ਼ਰੀਏ ਨਵੇਂ ਨੌਜਵਾਨ ਕੁੜੀਆਂ ਨੂੰ ਬਿਊਟੀ ਪਾਰਲਰ ਦਾ ਕੰਮ ਸਿਖਾਉਂਦੀ ਵੀ ਹੈ ਅਤੇ ਆਪਣੀ ਸੇਵਾਵਾਂ ਵੀ ਦਿੰਦੀ ਹੈ ਇਸਦੇ ਨਾਲ ਨਾਲ ਉਸਨੇ ਘੱਟੋ ਘੱਟ ਪੰਜਾਹ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਇਹ ਸਾਰੇ ਕੰਮ ਕਰਕੇ ਉਹ ਸਾਲ ਦਾ ਲਗਭਗ ਪੰਜ ਤੋਂ ਛੇ ਲੱਖ ਦਾ ਟਰਨਓਵਰ ਕਰ ਲੈਂਦੀ ਹੈ ਅਤੇ ਹੁਣ ਉਹ ਇੱਕ ਹੋਰ ਬ੍ਰਾਂਚ ਖੋਲ੍ਹਣ ਜਾ ਰਹੀ ਹੈ ਇੱਕ ਹੋਰ ਸ਼ਹਿਰ ਦੇ ਵਿੱਚ ਜਿੱਥੇ ਉਹ ਫਿਰ ਨਏ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਅਤੇ ਨਵੇਂ ਨੌਜਵਾਨ ਪੀੜ੍ਹੀ ਦੀ ਕੁੜੀਆਂ ਨੂੰ ਕੰਮ ਸਿਖਾਵੇਗੀ